ਖੇਤੀਬਾੜੀ ਪੰਜਾਬ ਦਾ ਮੁੱਖ ਕਿੱਤਾ ਹੈ ਪੁਰਾਣੇ ਸਮਿਆਂ ਤੋਂ ਖੇਤੀਬਾੜੀ ਪੰਜਾਬ ਦਾ ਮੁੱਖ ਕਿੱਤਾ ਰਿਹਾ ਹੈ ਪਿੰਡਾਂ ਵਿੱਚ ਜ਼ਿਆਦਾਤਰ ਲੋਕ ਖੇਤੀਬਾੜੀ ਉੱਤੇ ਹੀ ਨਿਰਭਰ ਕਰਦੇ ਹਨ ਉਨਾਂ ਦੇ ਪਰਿਵਾਰ ਦੇ ਅੱਗੇ ਜਿੰਨੇ ਵੀ ਬੱਚੇ ਹੁੰਦੇ ਹਨ ਉਹ ਵੀ ਸਾਰੇ ਖੇਤੀਬਾੜੀ ਹੀ ਕਰਦੇ ਹਨ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਖੇਤੀ ਉੱਤੇ ਹੀ ਨਿਰਭਰ ਕਰਦਾ ਹੈ ਇਸ ਤੋਂ ਇਲਾਵਾ ਵਪਾਰ ਦੀ ਗੱਲ ਕਰੀਏ ਤਾਂ ਸ਼ੁਰੂ ਤੋਂ ਹੀ ਜਿਵੇਂ ਕਿ ਲੱਕੜੀ ਦਾ ਕੰਮ ਕਰਨ ਲਈ ਤਰਖਾਣ ਲੋਹੇ ਦਾ ਕੰਮ ਕਰਨ ਲਈ ਲੁਹਾਰ ਆਦਿ ਹੁੰਦੇ ਹਨ ਘੜੇ ਦਾ ਕੰਮ ਕਰਨ ਲਈ ਘੁਮਾਰ ਹੁੰਦੇ ਹਨ ਇਹ ਕੰਮ ਪੀੜ੍ਹੀ ਦਰ ਪੀੜ੍ਹੀ ਇੱਦਾਂ ਹੀ ਚਲਦੇ ਰਹਿੰਦੇ ਹਨ ਅਤੇ ਇਹਨਾਂ ਦੇ ਪਰਿਵਾਰ ਦਾ ਜੋ ਵੀ ਗੁਜ਼ਾਰਾ ਹੁੰਦਾ ਹੈ ਇਸ 'ਤੇ ਹੀ ਨਿਰਭਰ ਕਰਦਾ ਹੈ